ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਸਰ ਤੁਸੀਂ ਪੰਜਾਬੀ ਤਾਂ ਬਹੁਤ ਵਧੀਆ ਬੋਲਦੇ ਹੋ ਠੀਕ ਅ ਅੱਛਾ ਠੀਕ ਹੈ ਠੀਕ ਹੈ ਚਲੋ ਵਧੀਆ ਤੁਸੀਂ ਮਤਲਬ ਸਿੱਖ ਧਰਮ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡਾ ਜਿਹੜਾ ਸਿੱਖ ਧਰਮ ਹੈ ਸਾਡੇ ਧਰਮ 'ਚ ਦਸ ਗੁਰੂ ਰਹੇ ਨੇ ਸਾਡੇ ਸਾਡੇ ਸਭ ਤੋਂ ਪਹਿਲੇ ਗੁਰੂ ਸਾਡੇ ਗੁਰੂ ਨਾਨਕ ਦੇਵ ਜੀ ਅਤੇ ਜਿਹੜੇ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਬਾਕੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਕ੍ਰਿਸ਼ਨ ਸਿੰਘ ਜੀ ਹੋਰ ਬਥੇਰੇ ਗੁਰੂ ਰਹੇ ਨੇ ਪਰ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਲ ਤੁਸੀਂ ਜ਼ਿਆਦਾ ਸੁਣੀ ਹੋਣੀ ਕਿਉਂਕਿ ਜਿਹੜੇ ਗੁਰੂ ਨਾਨਕ ਦੇਵ ਜੀ ਸੀ ਉਹਨਾਂ ਨੇ ਜਿਹੜੀ ਪੂਰੀ ਦੁਨੀਆ ਸੀ ਉਹ ਚੱਲ ਕੇ ਗਾਹ ਤੀ ਸੀ ਮਤਲਬ ਉਹ ਲੋਕਾਂ ਨੂੰ ਗਿਆਨ ਵੰਡਦੇ ਸੀ ਗੁਰੂ ਨਾਨਕ ਦੇਵ ਜੀ ਮਤਲਬ ਕਲਯੁੱਗ ਦੇ ਜ਼ਮਾਨੇ 'ਚ ਉਹਨਾਂ ਜਿਸ ਟਾਈਮ ਜਨਮ ਹੋਇਆ ਸੀ ਉਸ ਟਾਈਮ ਲੋਕ ਬਹੁਤ ਵਹਿਮ ਭਰਮ ਤਾਂਤਰਿਕ ਸ਼ਾਂਤਰਿਕ ਇਹਨਾਂ ਕੋਲ ਬਹੁਤ ਜਾਂਦੇ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਟਾਈਮ 'ਚ ਆ ਕੇ ਉਹ ਚੀਜ਼ਾਂ ਮਿਟਾਈਆਂ ਸੀ ਅਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਆਇਆ ਤਾਂ ਉੱਦੋਂ ਜਿਹੜਾ ਸੀਗਾ ਆਪਣੇ ਦੇਸ਼ 'ਚ ਸੀਗਾ ਇੱਕ ਰਾਜਾ ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਔਰੰਗਜ਼ੇਬ ਔਰੰਗਜ਼ੇਬ ਨੇ ਬਹੁਤ ਜ਼ੁਲਮ ਕੀਤੇ ਲੋਕਾਂ 'ਤੇ ਮੁਗਲਾਂ ਦਾ ਰਾਜਾ ਸੀ ਉਹ ਉਹਨੇ ਮਤਲਬ ਬਹੁਤ ਜ਼ੁਲਮ ਕੀਤੇ ਲੋਕਾਂ 'ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੇਸ਼ ਨੂੰ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਲਈ ਆਪਣੇ ਚਾਰੋਂ ਪੁੱਤਰਾਂ ਦੀ ਸ਼ਹੀਦੀ ਦਿੱਤੀ ਉਹਨਾਂ ਦੇ ਜਿਹੜੇ ਚਾਰ ਪੁੱਤਰ ਸੀ ਦੋ ਮਤਲਬ ਇੱਕ ਸਭ ਤੋਂ ਵੱਡੇ ਸੀਗੇ ਇੱਕ ਉਸ ਤੋਂ ਛੋਟੇ ਸੀ ਉਹਨਾਂ ਨੂੰ ਪਹਿਲਾਂ ਤਾਂ ਕਿਹਾ ਗਿਆ ਕਿ ਤੁਸੀਂ ਕਿਲ੍ਹਾ ਛੱਡੋ ਜਦੋਂ ਉਹਨਾਂ ਨੇ ਕਿਲ੍ਹਾ ਛੱਡਿਆ ਅਨੰਦਪੁਰ ਸਾਹਿਬ ਦੀ ਗੜੀ ਜਦੋਂ ਉਹਨਾਂ ਨੇ ਛੱਡੀ ਤਾਂ ਉਹ ਸਰਸਾ ਨਦੀ ਦੇ ਕਿਨਾਰੇ ਅਲੱਗ ਹੋ ਗਏ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਵੱਡੇ ਦੋਨੋਂ ਪੁੱਤਰ ਅਲੱਗ ਅਤੇ ਜਿਹੜਾ ਅੱਠ ਨੌ ਸਾਲ ਦਾ ਸੀ ਅਤੇ ਦੂਜਾ ਦਸ ਸਾਲ ਦਾ ਸੀ ਉਹ ਆਪਣੀ ਦਾਦੀ ਨਾਲ ਲ ਅਲੱਗ ਰਹਿ ਗਏ ਜਿਹੜੇ ਦੋ ਵੱਡੇ ਸਾਹਿਬਜ਼ਾਦੇ ਸੀ ਉਹ ਚਮਕੌਰ ਦੀ ਲੜਾਈ ਵਿੱਚ ਮਾਰ ਸ਼ਹੀਦ ਹੋ ਗਏ ਅਤੇ ਜਿਹੜੇ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਨੂੰ ਸਰਹਿੰਦ ਵਿੱਚ ਦੀਵਾਰਾਂ ਵਿੱਚ ਚਿਣ ਦਿੱਤਾ ਗਿਆ ਅਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਸੀਗੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਦਿੱਲੀ ਦਿੱਲੀ ਲਾਲ ਕਿਲ੍ਹੇ 'ਤੇ ਆਖਰੀ ਸਾਹ ਲਿੱਤੇ ਸੀ ਉਹਨਾਂ ਨੇ ਉੱਥੇ ਉਹਨਾਂ ਦਾ ਸੀਸ ਕੱਟ ਦਿੱਤਾ ਗਿਆ ਸੀ ਅਤੇ ਬਾਬਾ ਜੀ ਨੇ ਉਸ ਵੇਲੇ ਸ਼ਹੀਦੀ ਪਾ ਲਈ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਜਿਹੜੇ ਸੀਗੇ ਉਹ ਲੜਾਈ 'ਚ ਸ਼ਹੀਦ ਹੋ ਗਏ ਸੀ ਸਾਡੇ ਦੇਸ਼ ਨੇ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਲਈ ਆਪਣਾ ਸਭ ਕੁਛ ਵਾਰਿਆ ਇਹ ਹੈ ਸਾਡੀ ਕੌਮ ਇਹ ਹੈ ਸਾਡਾ ਸਿੱਖੀਜ਼ਮ ਹੋਰ ਕੁਛ ਸਰ ਠੀਕ ਹੈ ਸਰ ਜ਼ਰੂਰ ਜ਼ਰੂਰ ਸਰ ਜ਼ਰੂਰ ਓਕੇ ਧੰਨਵਾਦ ਜੀ ਥੈਂਕ ਯੂ